ਹੈਲੋ ਹਾਂਜੀ ਸਰ ਹਾਂਜੀ ਸਰ ਗੁਰਦੀਪ ਸਿੰਘ ਬੋਲ ਰਿਹਾਂ ਜੀ ਫਤਿਹ ਰਾਈਸ ਮਿੱਲ ਤੋਂ ਹਾਂਜੀ ਹਾਂਜੀ ਫਤਿਹਗੜ੍ਹ ਸਾਹਿਬ ਅਮਲੋਹ ਰੋਡ 'ਤੇ ਹੈ ਜੀ ਆਪਣਾ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਸਰ ਇਹਨਾਂ ਦੇ ਅਲੱਗ ਅਲੱਗ ਹਾਂਜੀ ਹਾਂਜੀ ਇਹਦੇ ਅਲੱਗ ਅਲੱਗ ਰੇਟ ਨੇ ਅਤੇ ਜਿਵੇਂ ਪੰਦਰਾਂ ਸੌ ਨੌ ਬੋਲਿਆ ਯਾ ਤਕਰੀਬਨ ਜੋ ਲੇਟੈਸਟ ਚੱਲ ਰਿਹਾ ਉਹ ਇਕੱਤੀ ਕੁ ਸੌ ਰੁਪਏ ਹੈਗਾ ਆਪਣੇ ਕੋਲ ਬਾਕੀ ਕੁਆਲਟੀ ਦੇ ਹਿਸਾਬ ਨਾਲ ਜਿੱਦਾਂ ਦਾ ਮੋਸ਼ਚਰ ਹੋਵੇਗਾ ਉਹ ਹਿਸਾਬ ਨਾਲ ਫਿਰ ਜਿੱਦਾਂ ਆਪਣੇ ਅਠਾਰਾਂ ਕੁ ਲੈ ਲੈਂਦੇ ਜੀ ਅਠਾਰਾਂ ਬਾ ਰੱਖਿਆ ਤਾਂ ਵੈਸੇ ਇੰਨੇ ਹੀ ਜੀ ਹਾਂ ਚਲੋ ਕੋਈ ਗੱਲ ਨਹੀਂ ਬਾਕੀ ਦੇਖਲਾਂਗੇ ਤੁਹਾਨੂੰ ਥੋੜ੍ਹੀ ਜਿਹਾ ਘਾਟਾ ਜਿਹਾ ਪੈਣ ਲੱਗ ਜਾਂਦਾ ਇਸ ਕਰਕੇ ਥੋੜ੍ਹਾ ਜਿਹਾ ਡਾਊਨ ਰੱਖਿਆ ਆਪਣੇ ਚਲੋ ਬਾਕੀ ਹਾਂਜੀ ਬਾਕੀ ਚਲੋ ਕਰਲਾਂਗੇ ਹਾ ਹਾਂਜੀ ਚਲੋ ਸਰ ਇਕ ਇੱਕ ਦੋ ਦਿਨ ਤੁਸੀਂ ਇੰਤਜ਼ਾਰ ਕਰ ਲਓ ਮੇਰੇ ਖਿਆਲ ਨਾਲ ਸ਼ਾਇਦ ਵੀ ਵੱਧਣ ਦੇ ਚਾਂਣਸ ਹੈਗੇ ਨੇ ਮਤਲਬ ਵੱਧ ਜੇਗਾ ਰੇਟ ਥੋੜ੍ਹਾ ਜਿਹਾ

ਹਾਂਜੀ ਉਹ ਹੈਗਾ ਉਹ ਇੰਨਾ ਕੁ ਹੈ ਉਹ ਸਾਢੇ ਕੁ ਬਿਆਲੀ ਹੈਗਾ ਉਹ ਸਾਢੇ ਕੁ ਬਿਆਲੀ ਸੌ ਰੁਪਏ ਹੈਗਾ ਹਾਂਜੀ ਸਾਰੇ ਲੈ ਲੈਂਦਾ ਆਪਣੇ ਕੋਲ ਵਰੈਟੀਆਂ ਹੈਗੀਆਂ ਤਿੰਨ ਚਾਰ ਲੈ ਲੈਂਦੇ ਆਪਾਂ ਹਾਂ ਸਾਰੀ ਵਰੈਟੀ ਆਪਾਂ ਲੈ ਲਾਵਾਂਗੇ ਹਾਂਜੀ ਹਾਂਜੀ ਹਾਂਜੀ ਪਰ ਥੋੜ੍ਹਾ ਜਿਹਾ ਹਾਂ ਹਾਂਜੀ ਹਾਂਜੀ ਹਾਂਜੀ ਤੁਸੀਂ ਇੱਦਾਂ ਤੁਸੀਂ ਇੱਦਾਂ ਕਰਿਓ ਰੇਟ ਥੋੜ੍ਹਾ ਵਧੀਆਂ ਲੱਗਜੇਗਾ ਥੋੜ੍ਹਾ ਜਿਹਾ ਹੋਰ ਇਕ ਦੋ ਦਿਨ ਤੁਸੀਂ ਉਨੂੰ ਖੜ੍ਹਾ ਲਿਓ ਮਤਲਬ ਮੋਸ਼ਚਰ ਥੋੜ੍ਹਾ ਠੀਕ ਆ ਜਾਵੇ ਹੈ ਨਾ ਮਤਲਬ ਸਾਨੂੰ ਥੋੜ੍ਹੀ ਕੁਆਲਿਟੀ ਵਧੀਆ ਮਿਲਜੇ ਵੀ ਰੇਟ ਉਸਦੇ ਮਤਲਬ ਉਦਾਂ ਹੀ ਮਿਲਜੇਗਾ ਵਧੀਆ ਬਾਕੀ ਰੇਟ ਦੀ ਹਾਂਜੀ ਹਾਂਜੀ ਉਹਨਾਂ ਨੇ ਵੀ ਵਧਾਇਆ ਥੋੜ੍ਹਾ ਜਿਹਾ ਉਹ ਬਸ ਉਹ ਕੁਆਲਿਟੀ ਉਹ ਭਾਲਦੇ ਨੇ ਕਹਿੰਦੇ ਵੀ ਰੇਟ ਦੀ ਕੋਈ ਪ੍ਰੋਬਲਬ ਨਹੀਂ ਹੈਗੀ ਐਦੀ ਵੀ ਮਤਲਬ ਬੰਦਾ ਜਿੱਦਾਂ ਦੀ ਕੁਆਲਟੀ ਲੈ ਕੇ ਆਉਂਦਾ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਉਹਦਾ ਰੇਟ ਹੈ ਉਹ ਡਿਸਾਈਡ ਹੋ ਜਾਂਦਾ ਹਾਂਜੀ ਤੁਸੀਂ ਕਿੱਥੋਂ ਬੋਲਦੇ ਕਿੱਥੋਂ ਅੱਛਾ ਆਪਣੇ ਕਾਫੀ ਗਾਹਕ ਨੇ ਫਤਿਹਗੜ੍ਹ ਸਾਹਿਬ ਦੇ ਬਾਕੀਆਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਅਤੇ ਏਰੀਏ ਤੋਂ ਆਪਣਾ ਹਾਂਜੀ ਸਰ ਆਪਾਂ ਮਿਲ ਕੇ ਹਾਂ ਗੱਲ ਕਰਲਾਂਗੇ ਕੋਈ ਗੱਲ ਨਹੀਂ ਜਿੰਨਾ ਹੋ ਸਕਿਆ ਆਪਾਂ ਤੁਹਾਡਾ ਡਿਸਕਾਊਂਟ ਜਿੰਨਾਂ ਵੀ ਹੋਵੇਗਾ ਆਪਾਂ ਕਰਦਾਂਗੇ ਹੈ ਨਾ ਜਿੰਨਾ ਵੀ ਹੋਇਆ ਠੀਕ ਹੈ ਥੈਂਕ ਯੂ